ਭੰਗੜਾ ਪੰਜਾਬ ਦੇ ਵਿੱਚ ਡਾਂਸ ਦੀ ਇੱਕ ਫੋਰਮ ਹੈ ਜਿਉਂ ਹੀ ਕਿਸੇ ਵੀ ਪੰਜਾਬੀ ਚਾਹੇ ਇਹ ਬਜ਼ੁਰਗ ਹੈ ਚਾਹੇ ਉਹ ਬੱਚਾ ਹੈ ਭਾਵੇਂ ਜਵਾਨ ਹੈ ਉਸ ਦੇ ਕੰਨਾਂ ਦੇ ਵਿੱਚ ਢੋਲ ਦੀ ਇੱਕ ਥਾਪ ਪੈਂਦੀ ਹੈ ਤਾਂ ਉਸਦੇ ਪੈਰ ਆਪਣੇ ਆਪ ਹੀ ਨੱਚਣਾ ਸ਼ੁਰੂ ਕਰ ਦਿੰਦੇ ਹਨ ਭੰਗੜੇ ਦੇ ਵਿੱਚ ਕਿਉਂਕਿ ਇਹ ਸਾਰੇ ਸਰੀਰ ਦੇ ਸੰਪੂਰਨ ਕਿਰਿਆ ਹੈ ਇਸ ਲਈ ਇਸ ਨੂੰ ਆਪਾਂ ਐਰੋਬਿਕਸ ਦੇ ਤੌਰ 'ਤੇ ਵੀ ਲੈ ਸਕਦੇ ਹਨ ਅਤੇ ਭੰਗੜਾ ਪੰਜਾਬੀਆਂ ਦੀ ਸਿਹਤਮੰਦ ਹੋਣ ਦਾ ਇੱਕ ਕਾਮਯਾਬ ਫੋਰਮ ਹੈ